ਸਰਦੇਸ਼ ਮੈਡਮ ਬੋਲਦੇ ਹੋ ਹਾਂਜੀ ਮੈਂ ਨਾ ਤਬਲਾ ਸਿੱਖਣਾ ਚਾਹੁੰਦੀ ਹਾਂ ਤੁਹਾਡੇ ਤੋਂ ਸਿਖਾ ਦਿਓ ਸਿਖਾ ਦੇਵੋਗੇ ਕਿੰਨੀ ਫੀਸ ਹੈ ਦੋ ਟਾਈਮ ਸਿੱਖਣਾ ਹੋਵੇ ਤਾਂ ਟਾਈਮ ਲੈ ਲਓਗੇ ਹਾਂਜੀ ਕੋਈ ਗੱਲ ਨਹੀਂ ਹਾਰਮੋਨੀਅਮ ਵੀ ਸਿਖਾ ਦੇਵੋਗੇ ਨਾਲ

ਠੀਕ ਹੈ ਜੀ ਕਿੰਨੇ ਵਜੇ ਆਵਾਂ ਸਵੇਰੇ ਅਤੇ ਸ਼ਾਮੀ ਹਾਂਜੀ ਸ਼ਾਮੀ ਅੱਛਾ ਅੱਛਾ ਠੀਕ ਹੈ ਹਰਮੋਨੀਅਮ ਦੀ ਫੀਸ ਕਿੰਨੀ ਹੈ ਠੀਕ ਹੈ ਜੀ ਅਗਰ ਸਿਤਾਰ ਸਿੱਖਣੀ ਹੋਵੇ ਤਾਂ ਠੀਕ ਹੈ ਜੀ ਹੋਰ ਕਿਹੜੇ ਕਿਹੜੇ ਇੰਸਟਰੂਮੈਂਟ ਹੈਗੇ ਤੁਹਾਡੇ ਕੋਲ ਸਿਤਾਰ ਹਰਮੋਨੀਅਮ ਤੋਂ ਇਲਾਵਾ ਢੋਲ ਹੈਗਾ ਜੀ ਢੋਲ ਵੀ ਸਿਖਾ ਦੇਵੋਗੇ ਨਾਲ ਅੱਛਾ ਅੱਛਾ ਢੋਲਕੀ ਨਾਲ ਕੁਛ ਅੱਛਾ ਅੱਛਾ ਅੱਛਾ ਕਦੋਂ ਤੋਂ ਸ਼ੁਰੂ ਕਰਾ ਮੈਂ ਅੱਛਾ ਜੀ ਅਡਰੈਸ ਕੀ ਹੈ ਠੀਕ ਹੈ ਜੀ ਠੀਕ ਹੈ ਜੀ ਮੈਂ ਨਾ ਬਾਹਰੋਂ ਆਉਣਾ ਏ ਸਿੱਖਣ ਅਤੇ ਕਿੰਨੇ ਵਜੇ ਦਾ ਬਸ ਪਹੁੰਚਦੀ ਤੁਹਾਡੇ ਫਾਜ਼ਿਲਕਾ ਤੱਕ ਠੀਕ ਹੈ ਠੀਕ ਹੈ ਜੀ